ਸ੍ਰੋਤਾਂ ਦੀ ਘਾਟ ਨਾਲ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਾਡੇ ਸਾਡੇ ਪਿੰਡ ਵਿੱਚ ਇਹਨਾਂ ਸਾਰੀ ਚੀਜ਼ਾਂ ਦੀ ਬਹੁਤ ਹੀ ਘੱਟ ਘੱਟ ਸਹੂਲਤਾਂ ਹੈ ਹਨ ਅਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਕਿ ਸੈਮੀਨਾਰ ਹੁੰਦੇ ਹਨ ਉਹ ਪਿੰਡਾਂ ਵਿੱਚ ਬਹੁਤ ਹੀ ਘੱਟ ਕਰਵਾਏ ਜਾਂਦੇ ਹਨ ਅਤੇ ਸ਼ਹਿਰਾਂ ਵਿੱਚ ਜਾ ਕੇ ਹੀ ਲੋਕਾਂ ਨੂੰ ਸੈਮੀਨਾਰ ਅਟੈਂਡ ਕਰਨੇ ਪੈਂਦੇ ਹਨ ਅਤੇ ਜਿਸ ਕਾਰਨ ਉੱਥੋਂ ਹੀ ਟੀਕਾਕਰਨ ਕੇ ਆਉਂਦੇ ਹਨ